ਹੈਲੋ ਹਾਂਜੀ ਭਾਅ ਜੀ ਕਪੂਰਥਲੇ ਤੋਂ ਬੋਲਦੇ ਜੀ ਭਾਅ ਜੀ ਆਪਣੀ ਕੱਪੜੇ ਦੀ ਦੁਕਾਨ ਐ ਠੀਕ ਹੈ ਭਾਅ ਜੀ ਭਾਅ ਜੀ ਮੈ ਨਾ ਤੁਹਾਡਾ ਪੇਜ ਦੇਖਿਆ ਸੀਗਾ ਵੈਬਸਾਈਟ 'ਤੇ ਤੇ ਤੁਹਾਡੇ ਕੱਪੜੇ ਬਹੁਤ ਵਧੀਆ ਲੱਗੇ ਸੀਗੇ ਜਿੱਦਾਂ ਕੀ ਨਾ ਹੁਣ ਮੈਂ ਬਾਹਰ ਜਾਣਾ ਸੀਗਾ ਤੇ ਮੇਰਾ ਇੱਕ ਫਰੈਂਡ ਨੇ ਵੀ ਬਾਹਰ ਜਾਣਾ ਹੈ ਤੇ ਤੁਸੀਂ ਸਾਨੂੰ ਕੋਈ ਸਟੋਕਸ ਦੱਸ ਦੋ ਜਿਹੜਾ ਵਿੰਟਰਸ ਲਈ ਵਧੀਆ ਰਹੂਗਾ ਆਪਣਾ ਆਪਾਂ ਨੂੰ ਪ੍ਰਾਈਜਿੰਗ ਵਗੈਰਾ ਦੱਸ ਦੋ ਦੀ ਕਿਹੜੀ ਚੀਜ਼ ਕਿੱਦਾਂ ਬੈਟਰ ਰਹੂਗੀ ਸਾਨੂੰ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਰਫ ਪੈਂਦੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਕੋਈ ਨੀ ਭਾਅ ਜੀ ਵਿਜਿਟ ਵੀ ਕਰ ਦਿਆਗੇ ਤੁਸੀਂ ਤਾਂ ਸਾਨੂੰ ਇੱਕ ਵਾਰੀ ਉਹਨਾਂ ਦੀ ਫੋਟੋ ਵਗੈਰਾ ਭੇਜ ਦੋ ਤੇ ਉਹ ਚੀਜ਼ ਖਰਾਬ ਤਾਂ ਨਹੀਂ ਹੋਊਗੀ ਜੇ ਤੱਕ ਕਿਤੇ ਬਾਹਰ ਜਾ ਕੇ ਫਿਰ ਉਹ ਖਰਾਬ ਹੋ ਜਾਵੇ ਵਗੈਰਾ ਠੀਕ ਹੈ ਭਾਅ ਜੀ ਤੇ ਠੀਕ ਆ ਠੀਕ ਠੀਕ ਹੈ ਭਾਅ ਜੀ ਠੀਕ ਹ ਤੇ ਸਾਨੂੰ ਥੋੜੇ ਬਹੁਤ ਸਮਰ ਦੇ ਕੱਪੜੇ ਵੀ ਚਾਹੀਦੇ ਹੋਊਗੇ ਕਿਉਂਕਿ ਫਿਰ ਹੀਟਰ ਵਗੈਰਾ ਲੱਗੇ ਹੁੰਦੇ ਆ ਨਾ ਘਰਾਂ ਦੇ ਅੰਦਰ ਫਿਰ ਜਿਆਦਾ ਗਰਮੀ ਲੱਗ ਜਾਂਦੀ ਤਾਂ ਉਹ ਪਾ ਕੇ ਬੈਸਟ ਰਹਿੰਦਾ ਅੰਦਰ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਠੀਕ ਆ ਭਾਅ ਜੀ ਠੀਕ ਹ ਭਾਜੀ ਤੁਸੀਂ ਫਸਟ ਕਾਪੀ ਰੱਖੀ ਹੋਈ ਆ ਬ੍ਰਾਂਡ 'ਚ ਤੁਹਾਡਾ ਪਾਰਟਨਰਸ਼ਿਪ ਵਗੈਰਾ ਅੱਛਾ ਜੀ ਕਿਹੜਾ ਬਰੈਂਡ ਆ ਭਾਅ ਜੀ ਹਾਂਜੀ ਹਾਂਜੀ ਠੀਕ ਹੈ ਭਾਅ ਜੀ ਠੀਕ ਹੈ ਹਾਂਜੀ ਹਾਂਜੀ ਭਾਅ ਜੀ ਤੁਸੀਂ ਸ਼ੂਜ਼ ਵਗੈਰਾ ਵੀ ਰੱਖ ਲੈਂਦੇ ਹੋ ਠੀਕ ਹੈ ਭਾਅ ਜੀ ਠੀਕ ਆ ਭਾਅ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਭਾਅ ਜੀ ਤੇ ਹੋਰ ਤੁਹਾਡੇ ਕੋਲ ਕੀ ਕੀ ਹੈ ਅਵੇਲੇਬਲ ਹੋਗਾ ਇਸ ਟਾਈਮ ਅਸੀਂ ਕਿਉਂਕੀ ਜਿਆਦਾ ਸ਼ੋਪਿੰਗ ਕਰਨੀ ਦਸ ਬਾਰਾਂ ਜਣਿਆ ਦੀ ਸ਼ੋਪਿੰਗ ਕਰਨੀ ਕੱਲਾ ਕੱਲਾ ਬੰਦਾ ਘੱਟੋ ਘੱਟ ਦੀ ਤਾਂ ਇਕ ਲੱਖ ਡੇਢ ਲੱਖ ਦੀ ਸ਼ੋਪਿੰਗ ਕਰੂਗਾ ਤੇ ਤੁਹਾਡੇ ਕੋਲ ਐਨਾ ਹਾਂਜੀ ਹਾਂਜੀ ਭਾਅ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਭਾਅ ਜੀ ਆਪਣੀ ਕਪੂਰਥਲਾ ਕਿੱਥੇ ਨੂੰ ਪੈਂਦੀ ਹ ਜੀ ਸ਼ੋਪ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਤੁਹਾਡੇ ਕੋਲ ਵਿਜਿਟ ਕਰਾਂਗੇ ਭਾਅ ਜੀ ਤੇ ਕਿੰਨੇ ਤੋਂ ਕਿੰਨੇ ਓਪਨ ਰਹਿੰਦੇ ਆ ਆਪਣੀ ਸ਼ੋਪ ਤੇ ਕਿਹੜੇ ਦਿਨ ਕਲੋਜ ਹੁੰਦੀ ਕਿਹੜਾ ਟਾਈਮ ਕਲੋਜ ਹੁੰਦੀ ਭਾਅ ਜੀ ਦੱਸ ਦਿਓ ਚੋਵੀ ਘੰਟੇ ਭਾਅ ਜੀ ਰਾਤ ਨੂੰ ਹੀ ਓਪਨ ਰਹਿੰਦੀ ਹੈ ਠੀਕ ਹੈ ਜੀ ਠੀਕ ਹੈ ਜੀ

ਹਾਂਜੀ ਹਾਂਜੀ ਹਾਂਜੀ ਠੀਕ ਆ ਭਾਅ ਜੀ ਤੇ ਸੰਡੇ ਨੂੰ ਬੰਦ ਸੰਡੇ ਬੰਦ ਹੁੰਦੀ ਨਾ ਭਾਅ ਜੀ ਠੀਕ ਹੈ ਭਾਅ ਈ ਬਹੁਤ ਭਾਈ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਅਸੀਂ ਜਰੂਰ ਥੋਡੀ ਦੁਕਾਨ ਵਿਜਿਟ ਕਰਕੇ ਜਾਵਾਂਗੇ ਤੇ ਵਧੀਆ ਅੱਗੇ ਤੇ ਜੇ ਸਾਨੂੰ ਸਟੋਕ ਵਧੀਆ ਲੱਗਿਆ ਤਾਂ ਅਸੀਂ ਹੋਰ ਵੀ ਅੱਗੇ ਸੁਜੈਸਟ ਕਰਾਂਗੇ ਬੰਦਿਆਂ ਨੂੰ ਠੀਕ ਆ ਭਾਅ ਜੀ ਜੀ ਓਕੇ ਭਾਅ ਜੀ ਓਕੇ ਭਾਅ ਜੀ ਓਕੇ ਸ਼ੁਕਰੀਆ ਬਾਏ ਸਤਿ ਸ਼੍ਰੀ ਅਕਾਲ ਜੀ